ਬਿਜਲੀ ਦੀ ਹੋਂਦ ਨੇ ਸਾਡੀ ਜ਼ਿੰਦਗੀਆਂ ਨੂੰ ਰੁਸ਼ਨਾਇਆ ਹੈ ਪਰ ਬਿਜਲੀ ਦਾ ਕੰਮ ਕਰਨ ਲੱਗੇ ਸਾਨੂੰ ਬਹੁਤ ਹੀ ਸਤਰਕ ਰਹਿਣਾ ਚਾਹੀਦਾ ਹੈ ਛੋਟੀ ਜਿਹੀ ਅਣਗਹਿਲੀ ਵੀ ਜਾਨਲੇਵਾ ਹੋ ਸਕਦੀ ਹੈ ਬਿਜਲੀ ਦੀਆਂ ਤਾਰਾਂ ਕਦੇ ਵੀ ਨੰਗੀਆਂ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ 'ਤੇ ਚੰਗੀ ਤਰ੍ਹਾਂ ਇੰਸੂਲੇਸ਼ਨ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਾਨੂੰ ਬਿਜਲੀ ਦੀਆਂ ਤਾਰਾਂ ਸਵਿੱਚ ਜਾਂ ਕਿਸੇ ਵੀ ਚੀਜ਼ ਨੂੰ ਗਿੱਲੇ ਹੱਥਾਂ ਨਾਲ ਹੱਥ ਨਹੀਂ ਲਗਾਉਣਾ ਚਾਹੀਦਾ ਸਾਨੂੰ ਬਿਜਲੀ ਦਾ ਕੋਈ ਵੀ ਕੰਮ ਕਰਨ ਲੱਗੇ ਰਬੜ ਦੀ ਚੱਪਲ ਜਾਂ ਲੱਕੜੀ ਦਾ ਕੋਈ ਡੰਡਾ ਆਪਣੇ ਹੱਥ ਵਿੱਚ ਫੜਨਾ ਚਾਹੀਦਾ ਹੈ ਤਾਂ ਜੋ ਸਾਨੂੰ ਸ਼ੋਕ ਨਾ ਲੱਗੇ ਇਸ ਤੋਂ ਇਲਾਵਾ ਸਾਡੇ ਘਰ ਦੀ ਜਾਂ ਕਿਸੇ ਵੀ ਬਿਲਡਿੰਗ ਦੀ ਚੰਗੀ ਤਰ੍ਹਾਂ ਅਰਥਿੰਗ ਹੋਣੀ ਚਾਹੀਦੀ ਹੈ ਘਰ ਵਿੱਚ ਵਰਤੀ ਜਾਣ ਵਾਲੀਆਂ ਬਿਜਲੀ ਦੇ ਕੋਈ ਵੀ ਯੰਤਰ ਅਰਥਿੰਗ ਹੋਣੀ ਚਾਹੀਦੀ ਹੈ